ਭਾਰਤ ਵਿੱਚ ਨੌਕਰੀ ਬਾਜ਼ਾਰ ਤਾਂ ਬਹੁਤ ਵਧੀਆ ਹਨ ਪਰ ਇੱਥੇ ਜੋ ਸਭ ਤੋਂ ਜ਼ਿਆਦਾ ਲੋਕਾਂ ਨੂੰ ਸਮੱਸਿਆਵਾਂ ਨੌਕਰੀ ਲੈਣ ਵਿੱਚ ਆ ਰਹੀਆਂ ਹਨ ਉਹ ਜਾਂ ਤਾਂ ਜੋ ਨੌਕਰੀ ਮਿਲਦੀ ਹੈ ਸਿਫਾਰਸ਼ ਦੇ ਨਾਲ ਮਿਲਦੀ ਹੈ ਜਾਂ ਭਾਈ ਭਤੀਜਾਵਾਦ ਦੇ ਨਾਲ ਮਿਲਦੀ ਹੈ ਅਤੇ ਨੌਕਰੀਆਂ ਕਰਨੀਆਂ ਵੀ ਹੁਣ ਅਸਾਨ ਨਹੀਂ ਰਹੀਆਂ ਜੋ ਵੀ ਨੌਕਰੀਆਂ ਕਰ ਰਹੇ ਹਨ ਉਹਨਾਂ ਦੇ ਲਈ ਦਬਾਅ ਹੀ ਐਨਾ ਜ਼ਿਆਦਾ ਪਾਇਆ ਜਾਂਦਾ ਹੈ ਕਿ ਕਈ ਲੋਕ ਤਾਂ ਨੌਕਰੀਆਂ ਵੀ ਛੱਡਣ ਲਈ ਹੀ ਤਿਆਰ ਹਨ ਅਤੇ ਜੋ ਪਰ ਇੱਥੇ ਹੁਣ ਆਬਾਦੀ ਐਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਸਾਰਿਆਂ ਨੂੰ ਰੁਜ਼ਗਾਰ ਦੇਣਾ ਵੀ ਮੁਸ਼ਕਲ ਹੈ